ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂ ਹਾਂਜੀ ਹਾਂਜੀ ਜਰੂਰ ਮੈਮ ਮੇਰਾ ਤਾਂ ਕੰਮ ਹੀ ਹੈ ਮੈਂ ਤਾਂ ਟੂਰਿਸਟ ਗਾਈਡ ਹਾਂ ਨਾ ਅਤੇ ਤੁਸੀਂ ਮੈਨੂੰ ਦੱਸੋ ਤੁਸੀਂ ਕਦੋਂ ਆ ਰਹੇ ਆ ਅੰਮ੍ਰਿਤਸਰ ਹਾਂਜੀ ਮੈਮ ਤੁਸੀਂ ਜੀ ਅੰਮ੍ਰਿਤਸਰ ਆਉਣਾ ਤਾਂ ਮਹਾਰਾਜਾ ਰਣਜੀਤ ਸਿੰਘ ਨਾ ਬਹੁਤ ਵੱਡੇ ਰਾਜਾ ਸੀ ਜਿਨਾਂ ਨੂੰ ਸੋਨੇ ਦੀ ਚਿੜੀਆ ਵੀ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਨੇ ਜਿਹੜੇ ਅੰਗਰੇਜ਼ ਸਾਡਾ ਹੈ ਪੰਜਾਬ ਦਾ ਸੋਨਾ ਚੁਰਾ ਕੇ ਲੈ ਗਏ ਸੀ ਉਹਨਾਂ ਤੋਂ ਸੋਨਾ ਲੈ ਕੇ ਵਾਪਿਸ ਅਤੇ ਇੱਥੇ ਹਰਿਮੰਦਰ ਸਾਹਿਬ ਦਾ ਗੇਟ ਬਣਵਾਇਆ ਸੀ ਜੋ ਅਜੇ ਵੀ ਹੈਗਾ ਤੁਸੀਂ ਦੇਖ ਸਕਦੇ ਹੋ ਆ ਕੇ ਅਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਇੱਕ ਗੋਬਿੰਦਗੜ੍ਹ ਕਿਲ੍ਹਾ ਹੈਗਾ ਵਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ ਉਹਨਾਂ ਦੇ ਜ਼ਮਾਨੇ ਦਾ ਅਤੇ ਉਹਦੇ ਅੰਦਰ ਗੁਫਾਵਾਂ ਹੈਗੀਆਂ ਜਿੱਥੇ ਉਹਨਾਂ ਦੇ ਘੋੜੇ ਦੋੜਦੇ ਹੁੰਦੇ ਸੀ ਜਿਹੜੇ ਲਾਹੌਰ ਤੱਕ ਜਾਂਦੇ ਸੀ ਪਾਕਿਸਤਾਨ ਹਾਂਜੀ ਅਤੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਹੋਰ ਵੀ ਬਹੁਤ ਕੁਛ ਹੈ ਤੁਸੀਂ ਆ ਕੇ ਮਿਲੋਂਗੇ ਅਤੇ ਹੋਰ ਵੀ ਬਹੁਤ ਕੁਛ ਜਾਣ ਸਕੋਗੇ ਠੀਕ ਹੈ ਹਾਂਜੀ ਹਾਂਜੀ ਮੈਮ ਠੀਕ ਥੈਂਕ ਯੂ ਧੰਨਵਾਦ ਧੰਨਵਾਦ